ਪੇਂਡੂ ਲੋਕਾਂ ਲਈ ਕਾਨੂੰਨੀ ਸੇਵਾਵਾਂ ਦੀ ਬੜੀ ਮੁਸ਼ਕਲ ਹੈ ਇਨ੍ਹਾਂ ਗੱਲਾਂ ਵੱਲ ਮੈਂ ਖਾਸ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਪਿੰਡਾਂ ਵਿੱਚ ਸੁਵਿਧਾਵਾਂ ਦੀ ਘਾਟ ਕਿਉਂ ਹੈ ਪਿੰਡ ਦੇ ਲੋਕ ਸਰਕਾਰ ਦਾ ਧਿਆਨ ਪਿੰਡਾਂ ਵੱਲ ਘੱਟ ਹੈ ਕਿਉਂਕਿ ਸਾਨੂੰ ਉੱਥੇ ਕੋਈ ਵਕੀਲ ਨਹੀਂ ਮਿਲਦਾ ਸਾਡੇ ਪਿੰਡ ਵਿੱਚ ਪੁਲਿਸ ਸਟੇਸ਼ਨ ਬੜੀ ਦੂਰ ਹੈ ਜਦੋਂ ਵੀ ਕਦੀ ਕੋਈ ਕੰਮ ਪੈਂਦਾ ਹੈ ਤਾਂ ਸਾਨੂੰ ਉੱਥੇ ਜਾਣਾ ਪੈਂਦਾ ਹੈ ਇਸ ਤਰ੍ਹਾਂ ਸਾਡੇ ਪਿੰਡ ਵਿੱਚ ਪਿੱਛੇ ਜਿਹੇ ਇੱਕ ਸੁਵਿਧਾ ਸੈਂਟਰ ਕੇਂਦਰ ਖੁੱਲ੍ਹਿਆ ਉਸ ਵਿੱਚ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਅੱਧਾ ਕੰਮ ਤਾਂ ਹੁੰਦਾ ਹੀ ਨਹੀਂ ਕਦੀ ਬਿਜਲੀ ਦਾ ਚਲੇ ਜਾਣਾ ਹੀ ਕੰਮ ਦਾ ਨਾ ਹੋਣਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਇਨ੍ਹਾਂ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਾਂ ਧੰਨਵਾਦ